ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਰੇ ਰਿਸ਼ਤਿਆਂ 'ਚੋਂ ਇੱਕ ਭੈਣ ਭਰਾ ਦਾ ਰਿਸ਼ਤਾ ਅਨੋਖਾ ਹੁੰਦਾ ਜਿਸ ਨੂੰ ਹਰ ਕੋਈ ਸਮਝਦਾ ਵੀ ਅਤੇ ਨਿਭਾਉਂਦਾ ਵੀ ਹੈ ਕਿ ਰੱਖੜੀ ਦਾ ਤਿਉਹਾਰ ਜਿਹੜਾ ਉਹ ਭੈਣ ਭਰਾ ਦੇ ਤਿਉਹਾਰ ਪਿਆਰ ਨੂੰ ਬਣਾ ਕੇ ਰੱਖਦੈ ਜੇਕਰ ਮੈਂ ਆਪਣੇ ਭੈਣ ਭਰਾਵਾਂ ਦੀ ਗੱਲ ਕਰਾਂ ਤਾਂ ਮੇਰੇ ਦੋ ਭਰਾ ਨੇ ਅਤੇ ਇੱਕ ਭੈਣ ਜਿਹੜੇ ਕਿ ਮੇਰੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਅਤੇ ਮੈਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੇਰੇ ਭੈਣ ਭਰਾ ਹਮੇਸ਼ਾ ਮੈਨੂੰ ਸਮਝਦੇ ਨੇ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਸਮਝਦੀ ਹਾਂ ਜਜਿਨ੍ਹਾਂ ਵਿੱਚੋਂ ਮੈਂ ਗੱਲ ਕਰਾਂ ਮੈਂ ਆਪਣੇ ਵੱਡੇ ਬ੍ਰਦਰ ਦੀ ਵੱਡੇ ਭਰਾ ਦੀ ਤਾਂ ਵੱਡੇ ਭਰਾ ਸਾਡੇ ਸਾਰਿਆਂ ਤੋਂ ਅਲੱਗ ਨੇ ਕਿਉਂਕਿ ਉਹ ਆਪਣੀ ਖੁਸ਼ੀ 'ਚ ਹਮੇਸ਼ਾ ਖੁਸ਼ ਰਹਿੰਦੇ ਨੇ ਠੀਕ ਹੈ ਪਰ ਸਾਡੀਆਂ ਖੁਸ਼ੀਆਂ ਦਾ ਉਹ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਅਸੀਂ ਉਹਨਾਂ ਤੋਂ ਛੋਟੇ ਹਾਂ ਉਹ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਅਸੀਂ ਵੱਖਰੇ ਵੀ ਨਹੀਂ ਕਹਿ ਸਕਦੇ ਪਰ ਜੇਕਰ ਗੱਲ ਕਰੀਏ ਸੁਭਾਅ ਦੀ ਤਾਂ ਉਹਨਾਂ ਦਾ ਸੁਭਾਅ ਸਾਡੇ ਤੋਂ ਅਲੱਗ ਹੈ ਠੀਕ ਹੈ ਉਹ ਸਾਡੇ ਵਾਂਗੂ ਨਹੀਂ ਸੋਚਦੇ ਕਿਉਂਕਿ ਵੱਡੇ ਹੋਣ ਦੇ ਨਾਲ ਅਤੇ ਉਹਨਾਂ ਦੀਆਂ ਘਰ ਦੀਆਂ ਜਿੰਮੇਵਾਰੀਆਂ ਸਾਨੂੰ ਸਾਡੇ ਲਈ ਸਾਡੇ ਪ੍ਰਤੀ ਸਭ ਕੁਝ ਹੈ ਨਾ ਉਹਨਾਂ ਦਾ ਵਿਵਹਾਰ ਥੋੜ੍ਹਾ ਚੇਂਜ ਹੁੰਦਾ ਕਿਉਂਕਿ ਉਹ ਸਾਡੇ ਬਾਰੇ ਬਹੁਤ ਸੋਚਦੇ ਨੇ ਸਾਡੀ ਪੜ੍ਹਾਈ ਨੂੰ ਲੈ ਕੇ ਸਾਡੇ ਖਾਣ ਪੀਣ ਨੂੰ ਲੈ ਕੇ ਅਤੇ ਜੇਕਰ ਮੈਂ ਗੱਲ ਕਰਾਂ ਆਪਣੀ ਭੈਣ ਦੀ ਤਾਂ ਉਹਨਾਂ ਦਾ ਮੇਰੇ ਨਾਲ ਮਤਲਬ ਬਹੁਤ ਅੱਛਾ ਰਿਸ਼ਤਾ ਹੈ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਆਪਾਂ ਇੱਕ ਦੂਜੇ ਨੂੰ ਉਹਦਾ ਰਹਿਣ ਸਹਿਣ ਮੇਰਾ ਰਹਿਣ ਸਹਿਣ ਖਾਣਾ ਪੀਣਾ ਇਕੱਠੇ ਸੋਣਾ ਇਹ ਗੱਲਾਂ ਸਾਰੀਆਂ ਜਿਹੜੀਆਂ ਉਹ ਸਾਡੀਆਂ ਮੈਚ ਕਰਦੀਆਂ ਨੇ ਕਿ ਇਸ ਦੇ ਨਾਲ ਹੀ ਉਹਨਾਂ ਦਾ ਮੇਰਾ ਅਤੇ ਉਹਦਾ ਪਹਿਰਾਵਾ ਹਮੇਸ਼ਾ ਸੇਮ ਹੁੰਦਾ ਅਸੀਂ ਜਿੱਥੇ ਵੀ ਜਾਨੇ ਹਾਂ ਇਕੱਠੇ ਜਾਂਦੇ ਹਾਂ ਇਕੱਠੇ ਰਹਿੰਦੇ ਹਾਂ ਕਿ ਹਰ ਗੱਲ ਨੂੰ ਅਸੀਂ ਮਤਲਬ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਅਤੇ ਉਹ ਉਸਦੀ ਪਸੰਦ ਨਾ ਪਸੰਦ ਮੇਰੀ ਪਸੰਦ ਨਾ ਪਸੰਦ ਸਭ ਨੂੰ ਸਾਨੂੰ ਦੋਨਾਂ ਨੂੰ ਇੱਕ ਦੂਜੇ ਬਾਰੇ ਪਤਾ ਹੁੰਦਾ ਅਤੇ ਅਸੀਂ ਇਸ ਲਈ ਕਿਸੇ ਵੀ ਰਿਸ਼ਤੇਦਾਰ ਦੇ ਜਾਈਏ ਤਾਂ ਸਾਨੂੰ ਸਾਰੇ ਕਹਿੰਦੇ ਨੇ ਕਿ ਤੁਸੀਂ ਸੇਮ ਪਾਉਂਦੀਆਂ ਹੋ ਸੇਮ ਖਾਂਦੀਆਂ ਹੋ ਹੈ ਨਾ ਸੇਮ ਰਹਿੰਦੀਆਂ ਹਰ ਸਾਡਾ ਰਹਿਣ ਸਹਿਣ ਦਾ ਢੰਗ ਤਰੀਕਾ ਸਭ ਤੋਂ ਅਲੱਗ ਹੈ ਅਤੇ ਅਸੀਂ ਫਿਰ ਵੀ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ ਜੇਕਰ ਮੈਂ ਆਪਣੇ ਛੋਟੇ ਭਰਾ ਦੀ ਗੱਲ ਕਰਾਂ ਤਾਂ ਮੇਰਾ ਛੋਟਾ ਭਰਾ ਆਰਮੀ 'ਚ ਹੈ ਜੋ ਕਿ ਬਹੁਤ ਹੀ ਸਮਝਦਾਰ ਹੈ ਉਸ ਦੀ ਸੋਚ ਸਾਡੇ ਸਾਰਿਆਂ ਨਾਲੋਂ ਅਲੱਗ ਹੈ ਉਹ ਇੱਕ ਸਨਸੀਅਰ ਬੋਆਏ ਕਹਿ ਸਕਦੇ ਆਂ ਸਨਸੀਅਰ ਲੜਕਾ ਹਰ ਗੱਲ ਨੂੰ ਚੰਗਾ ਸੋਚਦਾ ਪਰ ਸਾਡੇ ਭੈਣ ਭਰਾਵਾਂ 'ਚ ਇੰਨਾ ਜ਼ਿਆਦਾ ਪਿਆਰ ਹੈ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਰਹਿਣਾ ਵੀ ਪਸੰਦ ਨਹੀਂ ਕਰਦੇ ਹੈਗੇ ਅਤੇ ਇੱਕ ਦੂਜੇ ਨਾਲ ਲੜਾਈ ਵੀ ਬਹੁਤ ਕਰਦੇ ਹਾਂ ਕਿ ਇਹੀ ਰਿਸ਼ਤਾ ਭੈਣ ਭਰਾਵਾਂ ਦਾ ਹੁੰਦਾ ਕਿ ਜੋ ਹਰ ਗੱਲ ਨੂੰ ਸਾਬਿਤ ਕਰਦਾ ਹੈ ਕਿ ਅਸੀਂ ਜਿੱਥੇ ਵੀ ਜਾਨੇ ਹਾਂ ਸਾਨੂੰ ਸਾਰੇ ਲੋਕ ਬਹੁਤ ਪਸੰਦ ਕਰਦੇ ਨੇ ਕਿਉਂਕਿ ਸਾਡੀ ਜੇ ਜੇਕਰ ਅਸੀਂ ਸੁਭਾਅ ਪੱਖੋਂ ਕਹੀਏ ਜੇ ਅਸੀਂ ਆਪਣੇ ਰਹਿਣ ਸਹਿਣ ਪੱਖੋਂ ਕਹੀਏ ਤਾਂ ਸਭ ਕੁਝ ਸਾਡਾ ਸੇਮ ਹੀ ਹੈ ਜ਼ਿਆਦਾਤਰ ਕਿ ਅਸੀਂ ਇੱਕ ਦੂਜੇ ਦੇ ਨਾਲ ਹੀ ਚੱਲਦੇ ਹਾਂ ਸੋ ਮੈਂ ਇਹ ਸਾਰਿਆਂ 'ਚੋਂ ਇਹੀ ਕਹੂੰਗੀ ਕਿ ਕਿ ਇਹ ਜੋ ਵੀ ਸਾਡੇ ਵਿੱਚ ਜੋ ਵੀ ਵਿਭਿੰਨਤਾ ਹਨ ਪਰ ਕੁਝ ਜ਼ਿਆਦਾ ਨਹੀਂ ਥੋੜ੍ਹੀਆਂ ਥੋੜ੍ਹੀਆਂ ਨੇ ਇਸ ਲਈ ਇਹ ਗੱਲ ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਵੀ ਭੈਣ ਭਰਾ ਨੇ ਅਤੇ ਤੁਸੀਂ ਸਭ ਮਿਲ ਕੇ ਰਹੋ ਇੱਕ ਦੂਜੇ ਦਾ ਸਮਝਦਾਰੀ ਨਾਲ ਵਰਤੋਂ ਸਮਝਦਾਰੀ ਨਾਲ ਰਹੋ